ਮੈਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਜੋ ਵੱਡਾ ਸ਼ੌਂਕ ਹੈ ਕਿਤਾਬਾਂ ਪੜ੍ਹਨ ਦਾ ਹੈ ਮੈਂ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕਿਤਾਬਾਂ ਪੜ੍ਹ ਚੁੱਕਿਆ ਹਾਂ ਸਕੂਲ ਟਾਈਮ ਵੀ ਮੈਨੂੰ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਨਾਵਲ ਪੜ੍ਹਨੇ ਕਵਿਤਾਵਾਂ ਪੜ੍ਹਨੀਆਂ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਲੇਜ ਵਿੱਚ ਗਿਆ ਕੋਲੇਜ ਵਿੱਚ ਬਹੁਤ ਹੀ ਜ਼ਿਆਦਾ ਮੈਨੂੰ ਲਾਈਬਰੇਰੀ ਵਿੱਚ ਕਿਤਾਬਾਂ ਪੜ੍ਹਨ ਨੂੰ ਮਿਲੀਆਂ ਨਾਵਲ ਪੜ੍ਹਨ ਨੂੰ ਮਿਲੇ ਹੋਰ ਅਲੱਗ ਤੋਂ ਅਲੱਗ ਲੇਖਕਾਂ ਬਾਰੇ ਪਤਾ ਲੱਗਿਆ ਇਸ ਤੋਂ ਬਾਅਦ ਮੈਂ ਮਾਸਟਰ ਡਿਗਰੀ ਕੀਤੀ ਉਸ ਟਾਇਮ ਵੀ ਮੈਨੂੰ ਸ਼ੌਂਕ ਹੁੰਦਾ ਸੀ ਕਿ ਮੈਂ ਕਿਤਾਬਾਂ ਪੜ੍ਹਾਂ ਮੈਂ ਅਲੱਗ ਅਲੱਗ ਜਾਵਾਂ ਜਗ੍ਹਾ ਤੋਂ ਲੇਖਕਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਕਿਤਾਬਾਂ ਲਿਆਂਦੀਆਂ ਪੜਨੀਆਂ ਸ਼ੁਰੂ ਕੀਤੀਆਂ ਔਨਲਾਈਨ ਪੜ੍ਹਨੀਆਂ ਸ਼ੁਰੂ ਕੀਤੀਆਂ ਫ਼ਿਰ ਮੈਨੂੰ ਅਚਾਨਕ ਇੱਕ ਮੇਰਾ ਦੋਸਤ ਮਿਲਿਆ ਜੋ ਕਿ ਬੇਗਮਪੁਰੀ ਹੈ ਬੇਗਮਪੁਰ ਬੋਕਸ਼ੋ ਬੁਕ ਸ਼ੌਪ ਉਹਦੀ ਨਾਮ ਹੈ ਸ਼ੋਪ ਦਾ ਅਤੇ ਉਹ ਕਿਤਾਬਾਂ ਵੇਚਦਾ ਆ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕਿਤਾਬ ਕਹਿ ਦਿਓ ਉਹ ਆਪਣੇ ਪਸੰਦ ਦੀ ਉਸ ਦੇ ਲ ਅਨੁਸਾਰ ਹੀ ਤੁਹਾਨੂੰ ਉਹ ਲਿਆ ਕੇ ਦੇ ਦਿੰਦਾ ਕਿਤਾਬਾਂ ਮੈਂ ਉਸ ਤੋਂ ਕਈ ਕਿਤਾਬਾਂ ਮੰਗਾਈਆਂ ਜਿਨ੍ਹਾਂ ਵਿੱਚ ਮੈਂ ਹੁਣ ਦੱਸਦਾ ਕਿ ਜਿਵੇਂ ਕਿ ਇਕ ਪਿਛਲੇ ਸਾਲ ਕੁਝ ਸਮੇਂ ਪਹਿਲਾਂ ਇੱਕ ਫਿਲਮ ਵੀ ਆਈ ਸੀ ਉਸਨੇ ਆਪਣੀ ਕੱਢੀ ਸੀ ਮਿੰਟੂ ਨੇ ਮਿੰਟੂ ਗੁਰਸਰੀਆ ਉਹਦਾ ਨਾਮ ਹੈ ਪੂਰਾ ਇੱਕ ਪੱਤਰਕਾਰ ਵੀ ਰਹਿ ਚੁੱਕਿਆ ਹੈ ਉਹਨੇ ਆਪਣੀ ਲਾਈਫ ਬਾਰੇ ਆਪਣੇ ਬਾਰੇ ਆਪ ਬਿਆਨ ਕੀਤਾ ਆਪ ਹੀ ਲੇਖਕ ਹੈ ਉਹ ਉਹਨੇ ਆਪਣੇ 'ਤੇ ਇੱਕ ਕਿਤਾਬ ਲਿਖੀ ਜਿਸ ਕਿਤਾਬ ਦਾ ਨਾਮ ਸੀ ਡਾਕੂਆਂ ਦਾ ਮੁੰਡਾ ਉਹਨੇ ਦੱਸਿਆ ਕਿ ਕਿਵੇਂ ਉਹ ਪੜ੍ਹਦਾ ਪੜ੍ਹਦਾ ਨਸ਼ੇ ਵਿੱਚ ਪੈ ਗਿਆ ਨਸ਼ੇ ਦੇ ਪੈਣ ਦੇ ਕਾਰਨ ਉਹਨੇ ਸਾਰਾ ਆਪਣਾ ਘਰ ਪਰਿਵਾਰ ਬਰਬਾਦ ਕਰ ਦਿੱਤਾ ਪੈਸਾ ਬਰਬਾਦ ਕੀਤਾ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ ਸੀ ਹੌਲੀ ਹੌਲੀ ਉਹਨੂੰ ਇੱਕ ਅੰਤ 'ਤੇ ਜਾ ਕੇ ਦਿਖਾਈ ਦਿੱਤਾ ਕਿ ਜੋ ਵੀ ਕਰ ਰਿਹਾ ਗਲਤ ਕਰ ਰਿਹਾ ਆ ਬਹੁਤ ਗਲਤ ਜੋ ਰਾਹ 'ਤੇ ਚੱਲ ਰਿਹਾ ਨਸ਼ੇ ਦੇ ਰਾਹ 'ਤੇ ਉਹ ਇੱਕ ਦਿਨ ਉਹਨੂੰ ਬਰਬਾਦ ਕਰ ਦੇਗਾ ਉਹਨੇ ਹੌਲੀ ਹੌਲੀ ਆਪਣਾ ਰੂਲ ਚੇਂਜ ਕੀਤਾ ਆਪਣੀ ਲਾਈਫ ਚੇਂਜ ਕੀਤੀ ਪਰਿਵਰਤਨ ਲਿਆਂਦੇ ਉਹ ਪੱਤਰਕਾਰ ਬਣਿਆ ਉਹਨੇ ਨਸ਼ਾ ਛੱਡਣਾ ਸ਼ੁਰੂ ਕੀਤਾ ਹੌਲੀ ਹੌਲੀ ਜਿਹਨੇ ਆਪਣਾ ਕੀ ਬਹੁਤ ਸੁਧਾਰ ਕੀਤਾ ਇੱਕ ਨਰਕ ਵਾਲੀ ਜ਼ਿੰਦਗੀ 'ਚੋਂ ਨਿਕਲ ਕੇ ਵਧੀਆ ਜ਼ਿੰਦਗੀ ਵਿੱਚ ਆਇਆ ਅਤੇ ਉਹ ਆਪਣਾ ਪੱਤਰਕਾਰ ਬਣ ਕੇ ਲੋਕਾਂ ਨੂੰ ਦਿਖਾਇਆ ਵਧੀਆ ਤਰੀਕੇ ਨਾਲ ਕੰਮ ਕੀਤਾ ਉਸਨੇ ਸਾਰੀ ਕਿਤਾਬ ਵਿੱਚ ਆਪਣਾ ਦੱਸਿਆ ਕਿਵੇਂ ਨਸ਼ਾ ਕਰਦਾ ਰਿਹਾ ਅਤੇ ਕਿਵੇਂ ਆਪਣੇ ਨੂੰ ਆਪ ਨੂੰ ਸੁਧਾਰਿਆ ਉਸ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਅਸੀਂ ਜੇ ਕਿਸੇ ਗਲਤ ਰਾਹ 'ਤੇ ਜਾ ਰਹੇ ਆਂ ਅਸੀਂ ਆਪ ਹੀ ਜਾ ਰਹੇ ਹਾਂ ਅਤੇ ਆਪ ਹੀ ਉਸ ਰਸਤੇ ਤੋਂ ਵਾਪਸ ਆ ਸਕਦੇ ਹਾਂ ਉਹ ਆਪ ਯਤਨ ਕਰਨੇ ਪੈਣਗੇ ਹੌਸਲਾ ਕਰਨਾ ਪਵੇਗਾ ਬਹੁਤ ਮੁਸ਼ਕਿਲਾਂ ਆਉਂਦੀਆਂ ਆ ਉਹਨੇ ਕਿਤਾਬ ਨੇ ਸਿਖਾਇਆ ਕਿ ਸਾਨੂੰ ਜੇ ਗਲਤ ਰਾਹ 'ਤੇ ਜਾ ਰਹੇ ਹਾਂ ਤਾਂ ਬਹੁਤ ਮੁਸ਼ਕਿਲਾਂ ਆਉਣਗੀਆਂ ਉਸ ਪਿੱਛੇ ਆਉਣ ਨੂੰ ਪਰ ਜੇ ਅਸੀਂ ਨਹੀਂ ਡੋਲਾਂਗੇ ਤਾਂ ਇੱਕ ਨਾ ਇੱਕ ਦਿਨ ਅਸੀਂ ਆਪਣੇ ਸਹੀ ਰਸਤੇ 'ਤੇ ਜ਼ਰੂਰ ਪਹੁੰਚਾਂਗੇ ਅਤੇ ਉਹਦੀ ਕਿਤਾਬ ਵਧੀਆ ਲੱਗੀ ਮੈਨੂੰ ਅਤੇ ਲਿਖਦਾ ਬਹੁਤ ਵਧੀਆ ਆ ਜੋ ਉਹਦੀ ਲਿਖਤ ਹੈ ਵਧੀਆ ਆ ਉਸ ਤੋਂ ਬਾਅਦ ਮੈਨੂੰ ਉਹਦੀਆਂ ਹੋਰ ਕਿਤਾਬਾਂ ਵੀ ਬਹੁਤ ਵਧੀਆ ਲੱਗੀਆਂ